ਹੈਲੋ ਹਾਂਜੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਅਸੀਂ ਜੀ ਸੁੱਖ ਮਨਿਆਰੀ ਐਂਡ ਕਲੋਥ ਸ਼ੌਪ ਤੋਂ ਬੋਲ ਰਹੇ ਹਾਂ ਹਾਂਜੀ ਸਾਡੇ ਕੋਲ ਹੈ ਕੁੜਤੇ ਪਜਾਮੇ ਜੀ ਕੋਟਨ ਦੇ ਵੀ ਔਰ ਥੋੜੇ ਹੈ ਨਾ ਡਿਫਰੈਂਟ ਡਿਫਰੈਂਟ ਟਾਈਪ ਦੇ ਹੈਗੇ ਆ ਜੀ ਸਾਡੇ ਕੋਲੇ ਇਸ ਤੋਂ ਇਲਾਵਾ ਹਾਂਜੀ ਇਸ ਤੋਂ ਇਲਾਵਾ ਜੀ ਸਾਡੇ ਕੋਲ ਹਾਂਜੀ ਹਾਂਜੀ ਹੈਗੇ ਹੈ ਜੀ ਅਲੱਗ ਅਲੱਗ ਤਰ੍ਹਾਂ ਦੇ ਹੈ ਜੀ ਹਾਂਜੀ ਅਲੱਗ ਅਲੱਗ ਰੇਂਜ ਦੇ ਹੈ ਜੀ ਅਤੇ ਫਿਰ ਹੈ ਨਾ ਅਲੱਗ ਅਲੱਗ ਉਹਨਾਂ ਦਾ ਥੋੜਾ ਜਿਵੇਂ ਡਿ ਡਿਜ਼ਾਇਨਿੰਗ ਵੀ ਅਲੱਗ ਥੋੜੀ ਹਨਾ ਜਿਵੇਂ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ ਖੁਦ ਅਤੇ ਜਿੰਨੀ ਤੁਹਾਡੀ ਰੇਂਜ ਦੇ ਅਕੋਰਡਿੰਗ ਤੁਸੀਂ ਲੈਣਾ ਹੋਵੇ ਹਾਂਜੀ ਦੇਖ ਸਕਦੇ ਹੋ ਕੁੜਤੇ ਪਜਾਮੇ ਦਾ ਪੁੱਛ ਰਹੇ ਹੋ ਯਾਂ ਕਿਸ ਦਾ ਜੀ ਦੋ ਸੌ ਮਿੰਨੀਮਮ ਜੀ ਦੋ ਸੌ ਤੱਕ ਦਾ ਉਸ ਤੋਂ ਥੋੜੇ ਘੱਟ ਘੱਟ ਰੇਂਜ ਦੇ ਵੀ ਹੈਗੇ ਆ ਹਾਂਜੀ ਇਹ ਜੋ ਤੁਹਾਨੂੰ ਵਧੀਆ ਕੁਆਲਿਟੀ ਦਾ ਚਾਹੀਦਾ ਤਾਂ ਹਨਾ ਤਾਂ ਮੈਕਸੀਮਮ ਹਨਾ ਦੋ ਸੌ ਤੱਕ ਦਾ ਹੋਵੇਗਾ ਜਾਂ ਢਾਈ ਸੌ ਤੱਕ ਦੋ ਸੌ ਢਾਈ ਸੌ ਤੱਕ ਦਾ ਜੀ ਜਾਂ ਫਿਰ ਅਗਰ ਤੁਹਾਨੂੰ ਹਨਾ ਮਿਨੀਮਮ ਪ੍ਰਾਈਜ਼ ਦਾ ਚਾਹੀਦਾ ਹੈ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਹਨਾ ਉਹਦਾ ਅਲੱਗ ਅਲੱਗ ਪ੍ਰਾਈਜ਼ ਜਿਵੇਂ ਤੁਹਾਨੂੰ ਪਸੰਦ ਆਉਂਦਾ ਹੈ ਜੀ ਆਪਣੇ ਜੀ ਜਿਵੇਂ ਆਪਣੇ ਕੁੜੀਆਂ ਦੇ ਨਾ ਕੱਪੜੇ ਜਿਵੇਂ ਸਲਵਾਰ ਸੂਟ ਵਗੈਰਾ ਹਨਾ ਸਾਰੇ ਸਾੜੀਆਂ ਵਗੈਰਾ ਹਨਾ ਜਿਵੇਂ ਕੁੜੀਆਂ ਦੇ ਵੀ ਹੈਗੇ ਹੈ ਜੀ ਉਹ ਬਾਕੀ ਸੱਗੀ ਫੁੱਲਾਂ ਤੋਂ ਤੁਸੀਂ ਪੁੱਛਿਆ ਹੀ ਹੈ ਸਾਰਾ ਕੁੱਝ ਹੈਗਾ ਹੀ ਹੈ ਜੀ ਸਾਡੇ ਕੋਲ ਹਾਂਜੀ ਉਹ ਤੁਸੀਂ ਕਿਸੇ ਹੋਰ ਨੂੰ ਵੀ ਤੁਸੀਂ ਹੋਰ ਨੂੰ ਵੀ ਦੱਸ ਸਕਦੇ ਹੋ ਨਾ ਸਾਡੀ ਸ਼ੋਪ ਹੈ ਇੱਕ ਵਾਰ ਤੁਸੀਂ ਖੁਦ ਵੀ ਵਿਜ਼ਿਟ ਕਰਕੇ ਦੇਖ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਵੈਲਕਮ